ਜਦੋਂ ਮੈਂ ਸਵੇਰੇ ਸਾਜਰੇ ਉੱਠ ਕੇ ਗਰਾਊਂਡ ਵੱਲ ਨੂੰ ਜਾਂਦਾ ਹਾਂ ਅਤੇ ਉੱਥੇ ਜਾ ਕੇ ਭੱਜ ਨੱਠ ਕਰਕੇ ਆਪਣੇ ਸਰੀਰ ਨੂੰ ਗਰਮ ਕਰਕੇ ਫੁੱਟਬੋਲ ਦੇ ਗਰਾਊਂਡ ਵਿੱਚ ਉਤਰਦਾ ਹਾਂ ਅਤੇ ਉੱਥੋਂ ਦੇ ਉੱਥੇ ਆਪਣੀ ਟੀਮ ਦੇ ਬੰਦਿਆਂ ਨੂੰ ਮਿਲਦਾ ਹਾਂ ਸਾਰੇ ਯਾਰਾਂ ਮਿੱਤਰਾਂ ਨੂੰ ਮਿਲਦਾ ਹਾਂ ਅਤੇ ਉਨ੍ਹਾਂ ਦੇ ਗੈਲ ਫੁੱਟਬੋਲ ਦਾ ਮੈਚ ਲਾਉਂਦੇ ਹਨ ਉਸ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਕਿਉਂਕਿ ਉਦੋਂ ਅਸੀਂ ਸਾਰੇ ਮਿੱਤਰ ਰਲ ਕੇ ਖੇਡਦੇ ਹਨ ਅਤੇ ਆਪਣੇ ਸਰੀਰ 'ਤੇ ਮਿਹਨਤ ਕਰਦੇ ਹਨ ਅਤੇ ਅਸੀਂ ਆਪਣਾ ਖੇਡ ਕੇ ਜਦੋਂ ਥੱਕ ਟੁੱਟ ਕੇ ਘਰ ਵਾਪਸ ਆਉਂਦੇ ਹਨ ਉਸ ਟਾਈਮ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਮੈਂ ਆਪਣੇ ਮਨਪਸੰਦੀ ਖੇਡ ਅਤੇ ਆਪਣੇ ਮਨਪਸੰਦੀ ਦੋਸਤਾਂ ਗੈਲ ਖੇਡਦਾ ਹਾਂ ਜਿਸ ਕਾਰਨ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਆਪਣੇ ਸਰੀਰ ਨੂੰ ਤਾਜ਼ਾ ਤਾਜ਼ਾ ਤਾਜ਼ਾ ਮਹਿਸੂਸ ਕਰਦਾ ਹਾਂ